ਜਿਵੇਂ ਆਪਾਂ ਕੰਮ ਕਰ ਰਹੇ ਹਾਂ ਕਿਸੇ ਦੂਸਰੇ ਬੰਦੇ ਨੂੰ ਮੈਂ ਸਮਾਨ ਦੇਣਾ ਹੈ ਜਾਂ ਉਹਦੇ ਕੋਲੋਂ ਸਮਾਨ ਲੈਣਾ ਹੈ ਤਾਂ ਇੱਕ ਸਿਸਟਮ ਬਣ ਜਾਂਦਾ ਹੈ ਚੇਨ ਬਣ ਜਾਂਦੀ ਹੈ ਉਹਨੂੰ ਕੜੀ ਕਹਿ ਦਿੰਦੇ ਆਪਾਂ ਤਾਂ ਕਦੇ ਕਿਸੇ ਤੋਂ ਸਮਾਨ ਆਪਾਂ ਨੇ ਦੂਰ ਤੋਂ ਮੰਗਾ ਰਹੇ ਹਾਂ ਕੋਈ ਗੱਡੀ ਲੈ ਕੇ ਆ ਰਹੀ ਆ ਜਾਂ ਆਪਾਂ ਨੂੰ ਕੋਈ ਸਮਾਨ ਮਿਲ ਨਹੀਂ ਰਿਹਾ ਤਾਂ ਇੱਕ ਦੂਜੇ ਦੀ ਹੈਲਪ ਦੇ ਨਾਲ ਆਪਾਂ ਨੂੰ ਉਹਦਾ ਟਿਕਾਣਾ ਪਤਾ ਲੱਗਦਾ ਕਿ ਇਹ ਸਮਾਨ ਕਿੱਥੋਂ ਮਿਲ ਜਾਏਗਾ ਔਰ ਵਪਾਰਕ ਸੰਸਥਾਵਾਂ ਜਿਹੜੀਆਂ ਹੈਗੀਆਂ ਅਸਲ ਦੇ ਵਿੱਚ ਇੱਕ ਦੂਜੇ ਨਾਲ ਖੜ੍ਹਨ ਵਾਸਤੇ ਵੀ ਹੁੰਦੀਆਂ ਕਿਸੇ ਦੇ ਮਾੜੇ ਟਾਈਮ ਦੇ ਵਿੱਚ ਕਿਸੇ ਦੇ ਚੰਗੇ ਟਾਈਮ ਦੇ ਵਿੱਚ ਕਿਸੇ ਨੂੰ ਫਾਈਨੈਂਸ਼ਲੀ ਯਾਨੀ ਕਿ ਆਰਥਿਕ ਤੌਰ 'ਤੇ ਕੋਈ ਪ੍ਰੋਬਲਮ ਖੜ੍ਹੀ ਹੋ ਗਈ ਸਮੱਸਿਆ ਆ ਗਈ ਤਾਂ ਉਨ੍ਹਾਂ ਚੀਜ਼ਾਂ ਨੂੰ ਵੀ ਓਹ ਕਵਰਅੱਪ ਕਰੇ ਨਾਲ ਉਹਨਾਂ ਦੇ ਖੜ੍ਹੇ ਉਸੇ ਨੂੰ ਹੀ ਜ਼ਿਆਦਾ ਵਧੀਆ ਮੰਨਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਮੇਰੇ ਸ਼ਹਿਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈਗਾ ਇੱਕ ਦੂਜੇ ਦੇ ਨਾਲ ਖੜ੍ਹਨਾ ਕਰਨਾ ਜ਼ਰੂਰੀ ਵੀ ਹੈ ਇਹ ਚੀਜ਼